ਜੇ ਅਸੀਂ ਗਲੈਕਸੀ ਦੇ ਸੰਸਾਰ ਦੇ ਵਿੱਚ ਜਾਂ ਬ੍ਰਹਿਮੰਡ ਦੇ ਇਤਿਹਾਸ ਦੇ ਵਿੱਚ ਅਸੀਂ ਜਾਈਏ ਜਾਂ ਸਾਡੇ ਭਾਰਤ ਦਾ ਸਾਡੇ ਪੰਜਾਬ ਦਾ ਕੀ ਇਤਿਹਾਸ ਰਿਹਾ ਹੈ ਬ੍ਰਹਿਮੰਡ ਦੇ ਵਿੱਚ ਤਾਂ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਪੰਜਾਬ ਦੀ ਬੇਟੀ ਕਲਪਨਾ ਚਾਵਲਾ ਦਾ ਆਉਂਦਾ ਹੈ ਜਿਸ ਨੇ ਸਾਡੇ ਦੇਸ਼ ਦੇ ਮਾਣ ਨੂੰ ਵਧਾਉਣ ਦੇ ਲਈ ਅੰਤਰਿਸ਼ ਦੇ ਵਿੱਚ ਗਈ ਅਤੇ ਸਾਡੇ ਲਈ ਉਸਨੇ ਖੋਜਾਂ ਕਰਨ ਦੀ ਕੋਸ਼ਿਸ਼ ਕੀਤੀ ਪਰ ਕੁਝ ਅਨਲੱਕੀ ਜਾਂ ਕਹਿ ਸਕਦੇ ਹਾਂ ਅਸੀਂ ਖੁਸ਼ਕਿਸਮਤ ਨਾ ਹੋਣ ਕਰਕੇ ਜੋ ਉਹਨਾਂ ਦਾ ਜੋ ਰੋਕੇਟ ਸੀ ਰਸਤੇ ਦੇ ਵਿੱਚ ਹੀ ਕੋਈ ਟੈਕਨੀਕਲ ਫਲਟ ਪੈਣ ਦਾ ਕਰਕੇ ਜਿਹੜਾ ਬਲਾਸਟ ਹੋ ਗਿਆ ਜਿਸ ਦੇ ਵਿੱਚ ਜਿਹੜੀ ਪੰਜਾਬ ਦੀ ਧੀ ਕਲਪਨਾ ਚਾਵਲਾ ਇੱਕ ਇਤਿਹਾਸ ਬਣ ਕੇ ਰਹਿ ਗਈ ਪਰ ਸਾਨੂੰ ਅੱਜ ਵੀ ਮਾਣ ਹੈ ਉਸ ਬੇਟੀ 'ਤੇ ਜਿਸ ਨੇ ਸਾਡੇ ਪੰਜਾਬ ਦਾ ਸਾਡੇ ਦੇਸ਼ ਦਾ ਮਾਣ ਵਧਾਇਆ ਤਾਂ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਸੁਨੀਤਾ ਵਿਲੀਅਮ ਦੀ ਜਿਵੇਂ ਕਿ ਕਲਪਨਾ ਚਾਵਲਾ ਤੋਂ ਬਾਅਦ ਦੂਸਰੀ ਜਿਹੜੀ ਇੰਡੀਆ ਦੀ ਔਰਤ ਸੀ ਧੀ ਸੀ ਉਹ ਬ੍ਰਹਿਮੰਡ ਦੇ ਵਿੱਚ ਅੰਤਰਿਕਸ਼ ਦੇ ਵਿੱਚ ਗਈ ਤਾਂ ਉਸਨੇ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਮਾਣ ਨੂੰ ਬਹੁਤ ਵਧਾਇਆ ਤਾਂ ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਕੇ ਅਸੀਂ ਉਹਨਾਂ ਨੂੰ ਸਲਿਊਟ ਕਰਦੇ ਹਾਂ ਸਲਾਮੀ ਦਿੰਦੇ ਹਾਂ ਅਸੀਂ ਉਹਨਾਂ ਨੂੰ ਸਤਿਕਾਰ ਦਿੰਦੇ ਹਾਂ ਤਾਂ ਉਸ ਤੋਂ ਬਾਅਦ ਜੇ ਅਸੀਂ ਹੋਰ ਵੀ ਇਤਿਹਾਸ ਫਰੋਲਿਆ ਜਾਵੇ ਤਾਂ ਅਨੇਕਾਂ ਹੀ ਬਹੁਤ ਚਮਕਦੇ ਸਿਤਾਰੇ ਹਨ ਹਾਂ ਤਾਂ ਜਿਵੇਂ ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਰਾਕੇਸ਼ ਸ਼ਰਮਾ ਇਹਨਾਂ ਦਾ ਵੀ ਅੰਤਰਿਕਸ਼ ਖੋਜੀਆਂ ਦੇ ਵਿੱਚ ਇੱਕ ਵੱਡਾ ਪੱਧਰ ਦੇ ਉੱਤੇ ਨਾਮ ਆਉਂਦਾ ਹੈ ਸੋ ਸਾਡੇ ਪੰਜਾਬ ਅਤੇ ਦੇਸ਼ ਦਾ ਇਹਨਾਂ ਨੇ ਸਭ ਨੇ ਬਹੁਤ ਮਾਣ ਵਧਾਇਆ ਹੈ